ਮੇਰੀਆਂ ਪਸੰਦੀਦਾ ਹਰੇਕ ਤਰ੍ਹਾਂ ਦੀ ਕਿਤਾਬ ਜਿਹੜੀ ਆ ਮੈਨੂੰ ਪਸੰਦੀਦਾ ਆ ਕਿਸੇ ਦੀ ਜੀਵਨੀ ਪੜ੍ਹਨੀ ਧਾਰਮਿਕ ਕਿਤਾਬ ਜਾਂ ਟੂਰ ਦੇ ਸੰਬੰਧਿਤ ਕਿਤਾਬਾਂ ਮੈਂ ਟੂਰ ਦੇ ਸੰਬੰਧਿਤ ਪੜ੍ਹ ਕੇ ਹੀ ਜਿੱਕਣ ਜਾਣਾ ਹੋਵੇ ਤਾਂ ਟੂਰ ਸੰਬੰਧਿਤ ਕਿਤਾਬਾਂ ਪੜ੍ਹ ਕੇ ਹੀ ਜਾਂਦਾ ਹਾਂ ਜ਼ਿੰਦਗੀ ਵਿੱਚ ਜਿਹੜੇ ਜੀਵਨੀਆਂ ਹੈ ਮੈਂ ਭਗਤ ਸਿੰਘ ਮਹਾਤਮਾ ਗਾਂਧੀ ਲਕਸ਼ਮੀ ਬਾਈ ਚੰਦਰਸ਼ੇਖਰ ਅਜ਼ਾਦ ਇਹਨਾਂ ਦੀਆਂ ਕਈ ਤਰ੍ਹਾਂ ਦੀਆਂ ਜੀਵਨੀਆਂ ਜਿਹੜੀਆਂ ਮੈਂ ਪੜ੍ਹੀਆਂ ਹੈ ਅਤੇ ਪੜ੍ਹਨ ਦਾ ਕਾਰਨ ਇਹ ਹੈ ਕਿ ਇਹਦੇ ਨਾਲ ਬੰਦੇ ਨੂੰ ਲੱਗਦਾ ਕਿ ਸਾਨੂੰ ਜਿਹੜੇ ਦੇਸ਼ ਆਜ਼ਾਦ ਕਰਾਇਆ ਇਹਨਾਂ ਦਾ ਅਹਿਮ ਰੋਲ ਹੈ ਸਾਨੂੰ ਇਹਨਾਂ ਉ ਦੀ ਸੋਚ 'ਤੇ ਹੀ ਚੱਲਣਾ ਚਾਹੀਦਾ ਹੈ ਹਾਲ ਹੀ ਵਿੱਚ ਮੈਂ ਭਗਤ ਸਿੰਘ ਦੇ ਜੇਲ ਡੈਅਰੀ ਪੜ੍ਹੀ ਹੈ ਜਿਹਦੇ 'ਚ ਭਗਤ ਸਿੰਘ ਨੇ ਆਪਣੀ ਜੇਲ ਡੈਅਰੀ ਦੇ ਨਾਲ ਨਾਲ ਉਹਨਾਂ ਦੱਸਿਆ ਕਿ ਉਸ ਵੇਲੇ ਅਰਥਸ਼ਾਸਤਰ ਵਿਗਿਆਨ ਸਾਇੰਸ ਜੋ ਵੀ ਉਹਨੇ ਉਸ ਜ਼ਮਾਨੇ ਦੇ ਵਿੱਚ ਪੜ੍ਹਿਆ ਉਹਨੇ ਆਪਣਾ ਲਿਖਿਆ ਉਹਨੇ ਬਕਾਇਦਾ ਸਾਈਨ ਕੀਤੇ ਹਨ ਅਤੇ ਉਹ ਅਰਥ ਵਿਵਸਥਾ ਦਾ ਹਾਲ ਕੁਛ ਉਹ ਜਿਸ ਤਰ੍ਹਾਂ ਪਹਿਲਾਂ ਸੀਗਾ ਉਹੀ ਅਰਥਵਿਵਸਥਾ ਦਾ ਹਾਲ ਅੱਜ ਵੀ ਹੈ ਇਹੀ ਕਿਤਾਬਾਂ ਦੇ ਅੱਜ ਵੀ ਪੜ੍ਹਾਇਆ ਜਾਂਦਾ ਹੈ ਘੁੰਮਾ ਫਿਰਾ ਕੇ ਸਾਨੂੰ ਉਹਨਾਂ ਦੀਆਂ ਜੀਵਨੀਆਂ ਜਿਹੜੇ ਧਾਰਮਿਕ ਜਿੰਨੇ ਵੀ ਸ਼ਹੀਦ ਹੋਏ ਆ ਉਹਨਾਂ ਦੀਆਂ ਜੀਵਨੀਆਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਉਹਨਾਂ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਸਿੱਖਣਾ ਚਾਹੀਦਾ ਕਿ ਉਹਨਾਂ ਨੇ ਮਾਂ ਬਾਪ ਛੱਡ ਕੇ ਸਿਰਫ ਦੇਸ਼ ਲਈ ਹੀ ਕੰਮ ਕੀਤਾ ਅਤੇ ਦੂਸਰੇ ਉਹ ਟੂਰ ਦੀਆਂ ਕਿਤਾਬਾਂ ਜਿਸ ਵਿੱਚ ਟੂਰ ਦੀ ਪੜ੍ਹਦੇ ਹਾਂ ਕਿਤਾਬ ਤਾਂ ਤੁਹਾਨੂੰ ਟੂਰ ਦੇ ਵਿੱਚ ਇੱਕ ਜਾਣ ਵੇਲੇ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਹੈਰਾਨੀ ਨਹੀਂ ਹੁੰਦੀ ਘੁੰਮਣ ਵੇਲੇ ਜ਼ਿਆਦਾ ਤਕਲੀਫ ਨਹੀਂ ਹੁੰਦੀ ਤੁਸੀਂ ਆਪਣੇ ਐਨ ਮੋਟਿਵ 'ਤੇ ਪਹੁੰਚ ਜਾਂਦੇ ਹੋ ਅਤੇ ਆਪਣੇ ਮੰਜ਼ਿਲ 'ਤੇ ਪਹੁੰਚ ਕੇ ਦਰਸ਼ਨ ਦੀਦਾਰ ਜੋ ਵੀ ਕਰਨਾ ਘੁੰਮ ਫਿਰ ਕੇ ਵਾਪਸ ਆ ਜਾਂਦੇ ਹੋ